ਪ੍ਰਾਰਥਨਾ ਉਪਾਸਨਾ ਅਰਦਾਸ ਅਰਜੋਈ ਇਹ ਸਭ ਜਿਹੜੀਆਂ ਨੇ ਨਾ ਮਤਲਬ ਪਰਮਾਤਮਾ ਅੱਗੇ ਅਸੀਂ ਬੇਨਤੀ ਕਰਦੇ ਹਾਂ ਹੈ ਨਾ ਉਹ ਬੇਨਤੀ ਜਿਹੜੀ ਏ ਜਦੋਂ ਅਸੀਂ ਪਰਮਾਤਮਾ ਦੇ ਅੱਗੇ ਅਸੀਂ ਉਹਦੇ ਕੋਲੋਂ ਕੁਝ ਇਹਦੇ ਵਾਸਤੇ ਅੱਗੇ ਬੇਨਤੀ ਕਰਦੇ ਹਾਂ ਤਾਂ ਅਸੀਂ ਉਸ ਦੇ ਵਿੱਚ ਕੋਈ ਝੂਠ ਨਹੀਂ ਬੋਲ ਸਕਦੇ ਕਿਉਂ ਕਿਉਂਕਿ ਪਰਮਾਤਮਾ ਤਾਂ ਸਰਬ ਗਿਆਤਾ ਹੈ ਉਹ ਸਾਰੀ ਸਾਰਾ ਕੁਛ ਜਾਣਦਾ ਹੈ ਸੋ ਅਸੀਂ ਜਿਹੜਾ ਸਿੱਖ ਧਰਮ ਦੇ ਵਿੱਚ ਜਿਹੜਾ ਇਸਨੂੰ ਅਸੀਂ ਅਰਦਾਸ ਕਹਿੰਦੇ ਹਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਅਤੇ ਸਿੱਖ ਧਰਮ ਜਿਹੜਾ ਹੈ ਮਤਲਬ ਉਹ ਸਰਬ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਅਤੇ ਇਸ ਦੇ ਵਿੱਚ ਕਿਸੇ ਦਾ ਮਾੜਾ ਅਸੀਂ ਸੋਚ ਹੀ ਨਹੀਂ ਸਕਦੇ ਜੇ ਅਸੀਂ ਕੋਈ ਅਰਦਾਸ ਕਰਦੇ ਵੀ ਹਾਂ ਅਤੇ ਜਦੋਂ ਅਸੀਂ ਐਂਡ ਅਖੀਰ ਦੇ ਵਿੱਚ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਸ ਦੇ ਵਿੱਚ ਕਿਸੇ ਦਾ ਵੀ ਬੁਰਾ ਨਹੀਂ ਹੁੰਦਾ ਹੈ ਸੋ ਮਤਲਬ ਇਹ ਹੈ ਕਿ ਅਸੀਂ ਕਿਸੇ ਦੇ ਮਾੜੇ ਦੀ ਲਈ ਅਸੀਂ ਅਰਦਾਸ ਨਹੀਂ ਕਰਦੇ ਅਸੀਂ ਸਰਬੱਤ ਦੇ ਭਲੇ ਦੀ ਹੀ ਗੱਲ ਕਰਦੇ ਹਾਂ ਅਤੇ ਸਰਬੱਤ ਦਾ ਭਲਾ ਹੀ ਲੋੜਦੇ ਹਾਂ